ਮੇਰੀ ਸਭ ਤੋਂ ਪਸੰਦ ਗੇਮ ਹੈਂਡਬਾਲ ਹੈ ਹੈਂਡਬਾਲ ਵਿੱਚ ਬਹੁਤ ਸਾਰੀਆਂ ਕੁੜੀਆਂ ਵਧੀਆ ਪਾਰਟੀਸਪੇਟ ਕਰਦੀਆਂ ਨੇ ਜਿਹਨਾਂ ਰਾਹੀਂ ਉਹ ਆਪਣਾ ਨਾਮ ਨੂੰ ਉੱਚਾ ਕਰਦੀਆਂ ਅਤੇ ਉਹ ਕੁੜੀ ਦਾ ਨਾਮ ਹੈ ਹੈਗਾ ਤਨੂੰ ਅਤੇ ਉਹ ਬਹੁਤ ਵਧੀਆ ਖੇਡਦੀ ਆ ਅਤੇ ਉਹ ਜੋਨ 'ਚੋਂ ਜਿੱਤ ਕੇ ਜ਼ਿਲ੍ਹਾ ਪੱਧਰ 'ਤੇ ਗਈ ਹੈ ਜ਼ਿਲ੍ਹਾ ਪੱਧਰ ਤੋਂ ਸਟੇਟ ਗਈ ਆ ਸਟੇਟ ਤੋਂ ਸਟੇਟ ਤੋਂ ਨੈਸ਼ਨਲ ਗਈ ਆ ਨੈਸ਼ਨਲ ਜਾ ਕੇ ਉਹ ਕੁੜੀ ਵਧੀਆ ਗੇਮ ਖੇਡਦੀ ਆ ਅਤੇ ਉਸਨੇ ਆਪ ਦੇ ਸ ਸਕੂਲ ਦਾ ਪਿੰਡ ਦਾ ਨਾਮ ਉੱਚਾ ਕੀਤਾ ਹੈ ਜਿਸ ਕਾਰਨ ਉਹ ਆਪ ਦਾ ਮਤਲਬ ਕਿ ਉਹ ਆਪ ਅਗਾਂਹ ਵਧ ਸਕਦੀ ਹੈ ਅਤੇ ਉਹ ਆਪ ਦੇ ਪੇਰੈਂਟਸ ਦਾ ਮਤਲਬ ਮਾਤਾ ਪਿਤਾ ਦਾ ਨਾਮ ਉੱਚਾ ਕਰਦੀ ਹੈ ਅਤੇ ਮੈਂ ਉਸ ਕੁੜੀ ਨੂੰ ਮਿਲਣਾ ਚਾਹੁੰਦੀ ਹਾਂ ਕਿ ਉਸਨੇ ਇੰਨਾ ਵਧੀਆ ਗੇਮ ਵਧੀਆ ਖੇਡੀ ਅਤੇ ਕਿ ਉਸਨੇ ਆਪ ਦੇ ਸਕੂਲ ਦਾ ਪਿੰਡ ਦਾ ਨਾਮ ਉੱਚਾ ਕੀਤਾ ਉਹ ਕੁੜੀ ਨੂੰ ਮੈਂ ਮਿਲ ਕੇ ਬਹੁਤ ਉਹਦਾ ਕਰਦੀ ਹਾਂ ਉਹ ਖੇਡਦੇ ਨੇ ਹਰੇਕ ਨੂੰ ਆਦਰ ਸਤਿਕਾਰ ਨਾਲ ਬੁਲਾਉਂਦੀ ਹੈ ਅਤੇ ਉਹ ਹਰੇਕ ਦਾ ਸਤਿਕਾਰ ਕਰਦੀ ਆ ਉਹ ਹਾਰ ਜਿੱਤ ਹਾਰ ਜਿੱਤ ਦੀ ਭਾਵਨਾਵਾਂ ਨੂੰ ਬਰਾਬਰ ਸਮਝਦੀ ਹੈ ਹਾਰ ਜਿੱਤ ਨੂੰ ਬਰਾਬਰ ਸਮਝ ਕੇ ਜੇ ਉਹ ਹਾਰੇ ਤਾਂ ਤਾਂ ਵੀ ਉਸ ਨੂੰ ਆਏਂ ਹੁੰਦਾ ਕਿ ਮੈਂ ਜਿੱਤੀ ਹਾਂ ਉਸ ਨੂੰ ਮਿਹਨਤ ਕਰਕੇ ਵੀ ਬੰਦੇ ਨੂੰ ਖੇਡਾਂ ਜਵਾਕ ਆਪ ਦੇ ਹਾਲਤ ਨੂੰ ਬਰਾਬਰ ਸਮਝਦੀ ਆ ਉਹ ਉਹ ਉਸ ਨਾਲ ਮਿਲ ਕੇ ਖੇਡਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਪਤਾ ਲੱਗੇ ਕਿ ਉਹ ਕਿਵੇਂ ਵਧੀਆ ਖੇਡਦੀ ਆ ਅਤੇ ਮੈਂ ਵੀ ਉਹਦੇ ਵਾਂਗੂੰ ਬਣ ਸਕਾਂ ਅਤੇ ਮਤਲਬ ਉਹ ਹੈਂਡਬਾਲ ਦੀ ਪਲੇਅਰ ਹੈ ਮੈਂ ਵੀ ਹੈਂਡਬਾਲ ਦੀ ਪਲੇਅਰ ਏ ਪਰ ਮੈਨੂੰ ਓਨਾ ਉਹਦੇ ਜਿੰਨਾ ਇੰਨਾ ਇੰਟਰਸਟ ਨਹੀਂ ਜਿੰਨਾ ਉਹਨੂੰ ਸੰਭਵ ਸੰਬੰਧਿਤ ਹੈ ਅਤੇ ਇਸ ਕਰਕੇ ਉਸਨੂੰ ਮ ਮਿਲ ਕੇ ਬਹੁਤ ਸਾਰੀ ਖੇਡਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਾਂ